ਖੇਡਾਂ ਸਾਡੇ ਜੀਵਨ ਵਿੱਚ ਬਹੁਤ ਮਹੱਤਵਪੂਰਨ ਹਨ ਬਹੁਤ ਸਾਰੀਆਂ ਖੇਡਾਂ ਹਨ ਭਾਰਤ ਵਿੱਚ ਲ ਲਗਭਗ ਬਹੁਤ ਸਾਰੀਆਂ ਖੇਡਾਂ ਹਨ ਜਿਵੇਂ ਹੋਕੀ ਕ੍ਰਿਕੇਟ ਫੁੱਟਬਾਲ ਆਦਿ ਇਹਨਾਂ ਵਿੱਚੋਂ ਕਈ ਅੰਦਰੂਨੀ ਖੇਡਾਂ ਵੀ ਹਨ ਜਿਵੇਂ ਚੈੱਸ ਕੈਰਮ ਲੁੱਡੋ ਆਦਿ ਵੱਖ ਵੱਖ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਹਰ ਇੱਕ ਖੇਤਰ ਵਿੱਚ ਅਲੱਗ ਅਲੱਗ ਕੇਂਦਰ ਹੁੰਦੇ ਹਨ ਜੇ ਮੈਂ ਆਪਣੇ ਖੇਤਰ ਦੀ ਗੱਲ ਕਰਾਂ ਤਾਂ ਜਿੰਨੇ ਵੀ ਸਾਡੇ ਖੇਤਰ ਵਿੱਚ ਸਰਕਾਰੀ ਸਕੂਲ ਹਨ ਜੋ ਕਿ ਸਰਕਾਰ ਦੁਆਰਾ ਚਲਾਏ ਜਾਂਦੇ ਹਨ ਉਹਨਾਂ ਵਿੱਚ ਬੱਚਿਆਂ ਨੂੰ ਪ੍ਰੇਰਿਤ ਕਰਦੇ ਹਨ ਕਿ ਸਾਨੂੰ ਬਹੁਤ ਜ਼ਿਆਦਾ ਖੇਡਾਂ ਖੇਡਣੀਆਂ ਚਾਹੀਦੀਆਂ ਹਨ ਉਹ ਬੱਚਿਆਂ ਨੂੰ ਅਲੱਗ ਅਲੱਗ ਲੈਵਲ 'ਤੇ ਲੈ ਕੇ ਬੱਚਿਆਂ ਨਾਲ ਖੇਡਾਂ ਖੇਡਦੇ ਹਨ ਅਤੇ ਅਲੱਗ ਅਲੱਗ ਲੈਵਲ ਲੈ ਕੇ ਬੱਚਿਆਂ ਨੂੰ ਖਿਲਾਂਦੇ ਹਨ ਉਹ ਪਹਿਲੇ ਸਕੂਲ ਤੋਂ ਲੈ ਕੇ ਫੇਰ ਨੈਸ਼ਨਲ ਲੈਵਲ ਤੱਕ ਲੈ ਕੇ ਜਾਂਦੇ ਹਨ ਬੱਚਿਆਂ ਨੂੰ ਅਤੇ ਉਹ ਬੱਚਿਆਂ ਨੂੰ ਖੇਡਾਂ ਖਿਡਾਉਂਦੇ ਹਨ ਸਕੂਲ ਦੇ ਇਲਾਵਾ ਬਹੁਤ ਸਾਰੇ ਗੁਰਦੁਆਰੇ ਹਨ ਜੋ ਕਿ ਬੱਚਿਆਂ ਨੂੰ ਗੱਤਕਾ ਕਰਨ ਲਈ ਪ੍ਰੇਰਿਤ ਕਰਦੇ ਹਨ ਅਤੇ ਬੱਚਿਆਂ ਨੂੰ ਮੁਫਤ ਵਿੱਚ ਗੱਤਕਾ ਸਿਖਾਉਂਦੇ ਹਨ ਜੋ ਕਿ ਸਾਡੇ ਪੰਜਾਬੀ ਸੱਭਿਆਚਾਰ ਨੂੰ ਵੀ ਪ੍ਰੇਰਿਤ ਕਰਦਾ ਹੈ ਅਤੇ ਬੱਚਿਆਂ ਦੇ ਮਨ ਦੇ ਅੰਦਰ ਉਤਸ਼ਾਹ ਵੀ ਪੈਦਾ ਕਰਦਾ ਹੈ ਕਿ ਉਹ ਜਜ਼ਬਾ ਪੈਦਾ ਕਰਦਾ ਹੈ ਕਿ ਅਸੀਂ ਵੀ ਕੁਝ ਕਰੀਏ ਇਹਨਾਂ ਨੂੰ ਸਭ ਨੂੰ ਛੱਡ ਕੇ ਗੁਰਦੁਆਰੇ ਅਤੇ ਸਕੂਲਾਂ ਨੂੰ ਛੱਡ ਕੇ ਸਾਡੇ ਖੇਤਰ ਵਿੱਚ ਇੱਕ ਕ੍ਰਿਕੇਟ ਅਕੈਡਮੀ ਹੈ ਜਿਸਦਾ ਨਾਮ ਹੈ ਡਾਕਟਰ ਅਬਦੁਲ ਕ੍ਰਿਟਨ ਕ੍ਰਿਕੇਟ ਅਕੈਡਮੀ ਜੋ ਕਿ ਬੱਚਿਆਂ ਨੂੰ ਦੋ ਮਹੀਨੇ ਦੀ ਫਰੀ ਕ੍ਰਿਕਟ ਟ੍ਰੇਨਿੰਗ ਦਿੰਦੇ ਹਨ ਅਤੇ ਫਰੀ ਬੈਟ ਬੋਲ ਦੀ ਕਿੱਟ ਵੀ ਪ੍ਰਦਾਨ ਕਰਦੇ ਹਨ ਇਹ ਵੱਖ ਵੱਖ ਸਹੂਲਤਾਂ ਹਰ ਇੱਕ ਬੱਚੇ ਲਈ ਹੈ ਜੋ ਖੇਡਾਂ ਵਿੱਚ ਖੇਡਾਂ ਵਿੱਚ ਪਾਰਟੀਸਪੇਟ ਕਰਨਾ ਚਾਹੁੰਦਾ ਹੈ ਜੇ ਹੁਣ ਅਸੀਂ ਗੱਲ ਕਰੀਏ ਕਿ ਅਸੀਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਕਿਵੇਂ ਭਾਗ ਲੈ ਸਕਦੇ ਹਾਂ ਤਾਂ ਉਸ ਲਈ ਵੱਖ ਵੱਖ ਐਗਜ਼ਾਮ ਹੁੰਦੇ ਹਨ ਪਹਿਲੇ ਸਾਨੂੰ ਆਪਣੇ ਡਿਸਟ੍ਰਿਕਟ ਲੈਵਲ ਤੋਂ ਤਹਿਸੀਲ ਲੈਵਲ ਤੋਂ ਉੱਪਰ ਜਾਣਾ ਪੈਂਦਾ ਹੈ ਅਸੀਂ ਉਹ ਕਰਕੇ ਅਸੀਂ ਆਪਣੇ ਸਟੇਟ ਨੂੰ ਰੀਪ੍ਰਜੈਂਟ ਕਰਕੇ ਆਪਣੇ ਨੈਸ਼ਨਲ ਵਿੱਚ ਖੇਡਦੇ ਹਾਂ ਅਤੇ ਨੈਸ਼ਨਲ ਤੋਂ ਬਾਅਦ ਅਸੀਂ ਓਲੰਪਿਕਸ ਜਾਂ ਕੋਈ ਵੀ ਇੰਟਰਨੈਸ਼ਨਲ ਖੇਡ ਵਿੱਚ ਭਾਗ ਲੈ ਸਕਦੇ ਹਾਂ ਸਾਨੂੰ ਵੱਧ ਚੜ੍ਹ ਕੇ ਖੇਡਾਂ ਖੇਡਣੀਆਂ ਚਾਹੀਦੀਆਂ ਹਨ ਅਤੇ ਆਪਣਾ ਅਤੇ ਆਪਣੇ ਦੇਸ਼ ਨੂੰ ਰੀਪ੍ਰੇਜੈਂਟ ਕਰਨਾ ਚਾਹੀਦਾ ਹੈ ਅਤੇ ਆਪਣਾ ਨਾਮ ਅਤੇ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰਨਾ ਚਾਹੀਦਾ ਹੈ ਧੰਨਵਾਦ